ਹਾਂ ਮੈਂ ਖੇਡਾਂ ਵਿੱਚ ਨਿਰਪੱਖ ਖੇਡ ਅਤੇ ਖੇਡਾਂ ਦੀ ਮਹੱਤਤਾ ਨੂੰ ਸਮਝਾ ਸਕਦਾ ਹਾਂ ਖੇਡਾਂ ਵਿੱਚ ਦੋ ਪ੍ਰਤਿਦਵੰਦੀ ਇੱਕ ਦੂਸਰੇ ਦਾ ਪੂਰਾ ਜ਼ੋਰ ਲਾ ਕੇ ਸਾਹਮਣਾ ਕਰਦੇ ਹਨ ਇਸ ਲਈ ਉਹਨਾਂ ਦਾ ਫੈਸਲਾ ਸਾਨੂੰ ਨਿਰਪੱਖ ਤੌਰ 'ਤੇ ਕਰਨਾ ਚਾਹੀਦਾ ਹਾਂ ਤਾਂ ਕਿ ਜੇ ਕਿਸੇ ਨੂੰ ਇਹ ਨਾ ਲੱਗੇ ਕਿ ਕਿਸੇ ਵੱਲ ਇੱਕ ਦਾ ਪੱਖ ਰੱਖਿਆ ਗਿਆ ਹੈ ਖੇਡਾਂ ਅੱਜ ਕੱਲ੍ਹ ਵਿੱਚ ਬਹੁਤ ਮਹੱਤਵਪੂਰਨ ਹੁੰਦੀਆਂ ਰੱਖਦੀਆਂ ਹਨ ਜਿਵੇਂ ਕਿ ਖੇ ਖੇਡਾਂ ਖੇਡਣ ਨਾਲ ਮਨੁੱਖ ਸ ਸਰੀਰਕ ਅਤੇ ਮਾਨਸਿਕ ਤੌਰ 'ਤੇ ਤੰਦਰੁਸਤ ਰਹਿੰਦਾ ਹੈ